ਮੇਰਾ ਮਨਪਸੰਦ ਸਰਫਿੰਗ ਸਪੌਰਟ ਹੈ ਪਹਾੜਾਂ 'ਚ ਜਾਣਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਉੱਥੇ ਹੀ ਜ਼ਿਆਦਾ ਤੁਹਾਨੂੰ ਸ਼ਾਂਤੀ ਅਤੇ ਫਰੈਸ਼ ਏਅਰ ਮਿਲੇਗੀ ਕਿ ਜਿਹਦੇ ਨਾਲ ਇੱਕ ਤੁਹਾਡੀ ਆਪਣੀ ਜਿਹੜੀ ਹੋਬੀ ਹੈ ਉਹ ਵੀ ਹੋ ਜਾਏਗੀ ਅਤੇ ਸਰਫਿੰਗ ਵੀ ਕੀਤੀ ਜਾਏਗੀ ਮੈਨੂੰ ਪਹਾੜਾਂ ਦੀ ਸਰਫਿੰਗ ਕਰਨਾ ਜ਼ਿਆਦਾ ਅੱਛਾ ਲੱਗਦਾ ਹੈ